ਖੇਤੀਬਾੜੀ ਕਰਨ ਲਈ ਕਿਸਾਨਾਂ ਨੂੰ ਸਰਕਾਰ ਤੋਂ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਹਨ ਜਿਵੇਂ ਫਸਲਾਂ ਦੀ ਸਿੰਚਾਈ ਲਈ ਮੋਟਰਾਂ ਦੀ ਬਿਜਲੀ ਦੇ ਬਿਲ ਮਾਫ ਕੀਤੇ ਜਾਂਦੇ ਹਨ ਅਤੇ ਕਿਸਾਨਾਂ ਨੂੰ ਡੀਪੂ ਵੱਲੋਂ ਫਸਲਾਂ ਦੇ ਬੀਜ ਸਹੀ ਰੇਟ 'ਤੇ ਮਿਲਦੇ ਨੇ ਅਤੇ ਜਦੋਂ ਵੋਟਾਂ ਹੁੰਦੀਆਂ ਨੇ ਤਾਂ ਕਈ ਨੇਤਾਵਾਂ ਵੱਲੋਂ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਜਾਂਦੇ ਨੇ ਅਤੇ ਕਈ ਵਾਰ ਇਹ ਵਾਅਦੇ ਕੀਤੇ ਜਾਂਦੇ ਨੇ ਕਿ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ ਪਰ ਅਕਸਰ ਉਹ ਵਾਅਦੇ ਵਾਅਦੇ ਹੀ ਰਹਿ ਜਾਂਦੇ ਨੇ ਅਤੇ ਕਿਸਾਨਾਂ ਨੂੰ ਸੋਸਾਇਟੀ ਵੱਲੋਂ ਖੇਤੀਬਾੜੀ ਕਰਨ ਲਈ ਕਰਪੈਨਾ ਅਤੇ ਟਰੈਕਟਰ ਵੀ ਕਿਰਾਏ 'ਤੇ ਮਿਲਦੇ ਨੇ ਅਤੇ ਕਿਸਾਨਾਂ ਨੂੰ ਹਰ ਮਹੀਨੇ ਦੋ ਹਜ਼ਾਰ ਰੁਪਏ ਦਿੱਤੇ ਜਾਂਦੇ ਨੇ ਕਈ ਫਸਲਾਂ 'ਤੇ ਕਿਸਾਨਾਂ ਨੂੰ ਸਬਸਿਡੀ ਵੀ ਮਿਲਦੀ ਹੈ ਬਰਸਾਤ ਜਾਂ ਹੜ੍ਹਾਂ ਦੇ ਟਾਈਮ ਨੁਕਸਾਨ ਹੋਈਆਂ ਫਸਲਾਂ ਦੇ ਬਦਲੇ ਸਰਕਾਰ ਉਹਨਾਂ ਨੂੰ ਮੁਆਵਜ਼ਾ ਵੀ ਦਿੰਦੀ ਹੈ